ਮੈਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਮੈਂ ਪੇਂਟਿੰਗ ਰਾਹੀਂ ਉਹਨਾਂ ਦੇ ਮਤਲਬ ਰੰਗਾਂ ਦੇ ਰਾਹੀਂ ਮੈਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਮਤਲਵ ਉਹਨਾਂ ਦੇ ਵਿੱਚ ਦਰਸਾਣਾ ਚਾਹਦੀ ਆਂ ਜਿੱਦਾਂ ਕਿ ਮੈਂ ਇੱਕ ਖਾਸ ਕਰਕੇ ਜਿਵੇਂ ਕੋਈ ਕਿਸੇ ਕੋਈ ਆਰਟ ਨੇ ਪੇਂਟਿੰਗ ਬਣਾਈ ਹੋਵੇ ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਸਾਰੇ ਅਨੁਭਵ ਸਾਰਾ ਕੁਝ ਕੀਤਾ ਹੁੰਦਾ ਹੈ ਮੈਂ ਉਹਨਾਂ ਨੂੰ ਉਹਨਾ ਨੂੰ ਮਤਲਵ ਮੈਂ ਬੜੀ ਬਰੀਕੀ ਦੇ ਨਾਲ ਦੇਖਦੀ ਹਾਂ ਵੀ ਉਹਨਾਂ ਦੇ ਉਹਨਾਂ ਨੇ ਅੰਦਰੋਂ ਕੀ ਦਰਸਾਣ ਦੀ ਕੋਸ਼ਿਸ਼ ਕੀਤੀ ਹੈ ਮਤਲਵ ਕੀ ਉਹ ਪੇਂਟਿੰਗ ਦੇ ਰਾਹੀਂ ਆਪਣੇ ਅੰਦਰ ਦੀਆਂ ਪੜਾਸ ਕੱਢਦੇ ਆ ਭੜਾਸ ਕੱਢਦੇ ਹਨ ਉਹਨਾਂ ਰੰਗਾਂ ਦੇ ਰਾਹੀਂ ਆਪਣੇ ਦਿਲਾਂ ਦੀ ਭੜਾਸ ਕੱਢਦੀਆਂ ਹਨ ਇਦਾਂ ਮੈਂ ਇੱਕ ਵਾਰੀ ਕਿਸੇ ਮਤਲਬ ਕਿ ਸੰਮੇਲਨ ਤੇ ਗਈ ਜਿੱਥੇ ਕਿ ਪੇਂਟਿੰਗ ਲੱਗੀਆਂ ਹੋਈਆਂ ਸੀਗੀਆਂ ਉੱਥੇ ਮੈਂ ਉਹਨਾਂ ਨੂੰ ਸਾਰੀਆਂ ਪੇਂਟਿੰਗਾਂ ਨੂੰ ਬੜੀ ਬਰੀਕੀ ਦੇ ਨਾਲ ਵੇਖਦੀ ਆਂ ਤੇ ਉਹ ਕੀ ਉਹ ਪੇਂਟਿੰਗ ਸਿਰਫ ਇੱਕ ਪੇਂਟਿੰਗ ਦੇ ਤੌਰ ਤੇ ਨਹੀਂ ਦੇਖੀ ਉਹਨਾਂ ਦੇ ਅੰਦਰ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਹਨ ਮੈਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੀ ਆ ਕੀ ਉਹ ਕੀ ਕਹਿਣਾ ਚਾਹੁੰਦੀਆਂ ਹਨ ਜਿੱਦਾਂ ਕਿ ਉਹਨੇ ਕਿਸੇ ਨੂੰ ਇੱਕ ਪੇਂਟਿੰਗ ਬਣਾਈ ਸੀ ਇੱਕ ਕੁੜੀ ਸੀ ਜਿਸਨੂੰ ਕਿਨੂੰ ਜੰਜੀਰਾ ਦੇ ਨਾਲ ਬੰਨਿਆ ਹੋਇਆ ਸੀਗਾ ਤੇ ਉਹ ਆਪਣੀਆਂ ਉਹ ਜੰਜੀਰਾਂ ਨੂੰ ਤੋੜ ਕੇ ਉਹ ਉੱਡਣਾ ਚਾਹੁੰਦੀ ਸੀ ਮਤਲਬ ਕਿ ਉੱਡਣਾ ਚਾਹੁੰਦੀ ਸੀ ਉਹਨੂੰ ਮਤਲਬ ਸਾਰੇ ਪਾਸੇ ਉਹਨੂੰ ਜਕੜਿਆ ਹੋਇਆ ਸੀ ਪੂਰੀ ਤਰਾਂ ਉਹਨੂੰ ਜੰਗੀਰਾ ਨਾਲ ਬੰਨਿਆ ਸੀ ਮਤਲਵ ਕੀ ਇੱਕ ਕਿਸਮ ਦੇ ਜੰਗਲ ਦੇ ਵਿੱਚ ਜਿੱਦਾਂ ਬੰਦਾ ਫਸਿਆ ਹੁੰਦਾ ਇਸ ਤਰਾਂ ਉਹਦੇ ਨਾਲ ਸੀਗਾ ਤੇ ਉਹ ਉੱਡਣਾ ਚਾਹੁੰਦੀ ਸੀ ਲੇਕਿਨ ਔਰਤ ਜਿਹੜੀ ਹੁੰਦੀ ਉਹ ਆਪਣੀ ਜਿੰਮੇਵਾਰੀਆਂ ਦੀ ਵਿਚ ਇਦਾਂ ਫਸ ਜਾਂਦੀ ਹ ਤੇ ਫਿਰ ਵੀ ਉੱਡ ਨਹੀਂ ਸਕਦੀ ਮਤਲਬ ਕਿ ਉਹ ਮੈਨੂੰ ਦੇਖ ਕੇ ਮੇਰੇ ਮਨ ਦੇ ਅੰਦਰ ਮੈਨੂੰ ਬਹੁਤ ਜਿਆਦਾ ਮਤਲਬ ਮੈਨੂੰ ਦੁੱਖ ਹੋਇਆ ਮੈਨੂੰ ਔਰਤਾਂ ਦੇ ਪ੍ਰਤੀ ਬਹੁਤ ਜਿਆਦਾ ਕਿ ਉਹਨਾਂ ਨੇ ਬਹੁਤ ਜਿਆਦਾ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਆਪਣੀਆਂ ਭਾਵਨਾਵਾਂ ਨੂੰ ਮਾਰਨਾ ਪੈਂਦਾ ਉਹ ਬਹੁਤ ਕੁਝ ਕਰਨਾ ਚਾਹੁੰਦੀਆਂ ਨੇ ਲੇਕਿਨ ਆਪਣੀਆਂ ਜਿੰਮੇਵਾਰੀਆ ਤੋਂ ਉਹ ਮਤਲਬ ਬਚ ਨਹੀਂ ਸਕਦੀਆਂ ਔਰ ਉਹਨਾਂ ਨੂੰ ਮਤਲਬ ਕਿ ਨਹੀਂ ਕਰ ਕਰਨਾ ਚਾਹੁੰਦੀਆ ਵੀ ਨੇ ਲੇਕਿਨ ਉਹ ਕਰ ਨੀ ਸਕਦੀਆਂ ਸਿਰਫ ਇੱਕ ਜਿੰਮੇਵਾਰੀਆਂ ਵਾਸਤੇ